ਹਾਂਜੀ ਮੈਨੂੰ ਲਿਖਣ ਦਾ ਤਾਂ ਵੈਸੇ ਸ਼ੌਂਕ ਹੈਗਾ ਹੀ ਹੈਗਾ ਏ ਅਤੇ ਮੇਰੇ ਟੀਚੇ ਜਾਂ ਇਛਾਵਾਂ ਇਹ ਨਹੀਂ ਕਿ ਮੈਂ ਚਾਹੁੰਦੀ ਹਾਂ ਮੈਂ ਵਧੀਆ ਵਧੀਆ ਪੋਈ ਕਵਿਤਾਵਾਂ ਲਿਖਾਂ ਵਧੀਆ ਵਧੀਆ ਕਹਾਣੀਆਂ ਲਿਖਾਂ ਬਾਲ ਕਹਾਣੀਆਂ ਲਿਖਾਂ ਮੈਨੂੰ ਬਾਲ ਕਹਾਣੀਆਂ ਮੈਨੂੰ ਵੀ ਪੜ੍ਹਨੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਬੱਚਿਆਂ ਵਾਲੀਆਂ ਕਹਾਣੀਆਂ ਹੁੰਦੀਆਂ ਨੇ ਜੋ ਮੈਨੂੰ ਪੜ੍ਹਨੀਆਂ ਇੰਨੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਬਾਲ ਕਹਾਣੀਆਂ ਜ਼ਿਆਦਾ ਤੋਂ ਜ਼ਿਆਦਾ ਲਿਖਾਂ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹ ਕੇ ਬੱਚੇ ਵੀ ਖੁਸ਼ ਹੋਣ ਮੋਟੀਵੇਟ ਮੋਟੀਵੇਟ ਵੀ ਹੋਣ ਇਹ ਨਹੀਂ ਕਹਿੰਦੀ ਹਾਸੇ ਵਾਲੀਆਂ ਕਹਾਣੀਆਂ ਲਿਖਾਂ ਮੋਟੀਵੇਟ ਕਹਾਣੀਆਂ ਵੀ ਲਿਖਾਂ ਜਿਹਦੇ ਨਾਲ ਬੱਚੇ ਵੀ ਖੁਸ਼ ਹੋਣ ਅਤੇ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲਦਾ ਰਹੇ ਅਤੇ ਮੈਂ ਆਪਣੀ ਲਿਖਤ ਨਾਲ ਪ੍ਰਾਪਤ ਮੈਂ ਮੈਂ ਚਾਹੁੰਦੀ ਹਾਂ ਕਿ ਮੈਂ ਮੇਰੀ ਇੰਨੀ ਵਧੀਆ ਕਹਾਣੀਆਂ ਹੋਣ ਕਵਿਤਾਵਾਂ ਹੋਣ ਜੋ ਵੀ ਮੈਂ ਲਿਖਾ ਮਤਲਬ ਉਹ ਮੈਨੂੰ ਇੰਨਾ ਵਧੀਆ ਹੋਵੇ ਸਾਰੇ ਜਾਣੇ ਪੜ੍ਹ ਕੇ ਮੇਰੀ ਤਾਰੀਫ ਕਰਨ ਤਾਰੀਫ ਦੇ ਨਾਲ ਨਾਲ ਮੈਨੂੰ ਵਧੀਆ ਵਧੀਆ ਮੈਨੂੰ ਅਚੀਵਮੈਂਟਸ ਹੋਣ ਤਾਂ ਜੋ ਮੈਂ ਆਪਣੇ ਮਾਪਿਆਂ ਨੂੰ ਆਪਣੇ ਫਰੈਂਡਸ ਨੂੰ ਦੱਸ ਸਕਾਂ ਕਿ ਮੈਨੂੰ ਮੈਂ ਜੋ ਮੇਰੀ ਲਿਖਣ ਦੀ ਕਲਾ ਏ ਕਿ ਮੈਂ ਉਹਨੂੰ ਕਿਵੇਂ ਨਿਖਾਰਿਆ ਏ ਕਿਵੇਂ ਉਭਾਰਿਆ ਹੈ ਅਤੇ ਕਿਸ ਤਰ੍ਹਾਂ ਮੈਂ ਉਹਨੂੰ ਆਪਣੀ ਕਲਾ ਨੂੰ ਬਾਹਰ ਲੈ ਕੇ ਆਉਂਦਾ ਏ ਅਤੇ ਤੁਸੀਂ ਵੀ ਆਪਣੀ ਕਲਾ ਨੂੰ ਇਸੇ ਤਰ੍ਹਾਂ ਬਾਹਰ ਲੈ ਕੇ ਆ ਸਕਦੇ ਹੋ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਕਲਾ ਮੇਰੇ ਪੂਰੀ ਹੋ ਸਕੇ ਅਤੇ ਮੈਂ ਆਪਣੇ ਮਾਪਿਆਂ ਨੂੰ ਅਤੇ ਆਪਣੇ ਮਿੱਤਰ ਸਾਥੀਆਂ ਨੂੰ ਪਰਾਊਡ ਫੀਲ ਕਰਾਂ ਸਕਾਂ